ਦੇਖੋ ਘੋੜ ਸਵਾਰੀ ਕਰਦੇ ਸਮੇਂ ਮੇਰੇ ਨਾਲ਼ ਬਹੁਤ ਹੀ ਜ਼ਿਆਦਾ ਅਨੁਭਵ ਹੋਏ ਨੇ ਯਾਦਗਾਰ ਮੇਰੇ ਨਾਲ਼ ਮੇਰੀਆਂ ਬਹੁਤ ਘੋੜਿਆਂ ਨਾਲ਼ ਬਹੁਤ ਯਾਦਗਾਰਾਂ ਜੁੜੀਆਂ ਹੋਈਆਂ ਨੇ ਕਿਉਂਕਿ ਮੈਨੂੰ ਬਚਪਨ ਤੋਂ ਹੀ ਘੋੜਿਆਂ ਦਾ ਸ਼ੌਂਕ ਹੈ ਮੇਰੀ ਫੈਮਲੀ ਨੂੰ ਸਾਰਿਆਂ ਨੂੰ ਮੇਰੇ ਦਾਦੇ ਚਾਚੇ ਤਾਏ ਡੈਡੀ ਸਭ ਨੇ ਘੋੜੇ ਰੱਖੇ ਹੋਏ ਨੇ ਮੈਂ ਰਿਹਾ ਸ਼ੁਰੂ ਤੋਂ ਘੋੜਿਆਂ ਦੇ ਵਿੱਚ ਹਾਂ ਉਹ ਵੀ ਮੇਰਾ ਇੱਕ ਮਨਪਸੰਦ ਜੋ ਕਹਿ ਸਕਦੇ ਹਾਂ ਆਪਾਂ ਘੋੜਿਆਂ ਵਿੱਚ ਮੇਰੀ ਬਹੁਤ ਹੀ ਜ਼ਿਆਦਾ ਰੁਚੀ ਹੈ ਇੱਕ ਵਾਰ ਮੈਂ ਮੇਲੇ 'ਤੇ ਗਿਆ ਸੀ ਘੋੜੇ ਨੂੰ ਲੈ ਕੇ ਅਤੇ ਉੱਥੋਂ ਕੀ ਹੋਇਆ ਮੈਂ ਘੋੜੇ 'ਤੇ ਜਾ ਰਿਹਾ ਸੀਗਾ ਮਤਲਬ ਘੋੜਾ ਮੈਂ ਭਜਾਇਆ ਹੋਇਆ ਸੀਗਾ ਪੂਰਾ ਕਿਉਂਕਿ ਰੇਸ ਚੱਲ ਰਹੀ ਸੀ ਅਤੇ ਇੱਕ ਵਾਰੀ ਨਾ ਮੈਂ ਗਿਰਿਆ ਸੀਗਾ ਉੱਥੋਂ ਮੇਰਾ ਗਿੱਟਾ ਟੁੱਟ ਗਿਆ ਸੀਗਾ ਅਤੇ ਘੋੜੇ ਨੇ ਵਗਾਹ ਕੇ ਮਾਰਿਆ ਸੀ ਮੈਨੂੰ ਅਤੇ ਇਕ ਹੋਰ ਮਤਲਬ ਜਦੋਂ ਜਾਣੀ ਵਧੀਆ ਲੱਗਦਾ ਮੈਨੂੰ ਘੋੜਿਆਂ 'ਤੇ ਅਤੇ ਮੈਨੂੰ ਸ਼ੌਂਕ ਆ ਸ਼ੁਰੂ ਤੋਂ ਘੋੜਿਆਂ ਦਾ ਬਹੁਤ ਜ਼ਿਆਦਾ ਅਤੇ ਮੈਂ ਵੀ ਰੱਖੇ ਹੋਏ ਨੇ ਮੈਂ ਅਰਬੀ ਘੋੜਾ ਰੱਖਿਆ ਹੋਇਆ ਹੈ ਅਤੇ ਮਤਲਬ ਯਾਦਗਾਰੀ ਤਾਂ ਮੇਰੇ ਨਾਲ਼ ਇਹੀ ਆ ਕਿ ਮੈਂ ਘੋੜੇ ਤੋਂ ਗਿਰ ਕੇ ਗਿੱਟਾ ਤੁੜਾਇਆ ਸੀ ਆਪਣਾ ਸੱਜੇ ਪੈਰ ਦਾ ਅਤੇ ਬਸ ਮੈਨੂੰ ਸ਼ੌਂਕ ਆ ਜਾਣੀ ਸ਼ੁਰੂ ਤੋਂ ਮੈਨੂੰ ਘੋੜਿਆਂ ਦਾ ਮਤਲਬ ਵਧੀਆ ਲੱਗਦੇ ਨੇ ਮੈਨੂੰ ਜਾਨਵਰ ਨੇ ਇਹ ਪਿਆਰ ਬਾਹਲਾ ਮੇਰਾ ਇਹਨਾਂ ਨਾਲ਼